ਮੈਨੂੰ ਬੁਣਾਈ ਦੇ ਸਭ ਪੈਟਰਨ ਆਉਂਦੇ ਹਨ ਮੈਂ ਜੋ ਕਿ ਆਪਣੇ ਘਰੋਂ ਸਿੱਖੇ ਹੈ ਆਪਣੀ ਮਾਂ ਕੋਲੋਂ ਸਿੱਖੇ ਹੈ ਅਤੇ ਫਿਰ ਜਿੱਦਾਂ ਜਿੱਦਾਂ ਮੈਂ ਵੱਡੀ ਹੋਈ ਤਾਂ ਮੈਂ ਆਪਣੇ ਦਾਦੀ ਕੋਲੋਂ ਵੀ ਸਿੱਖੇ ਮੈਨੂੰ ਹਰ ਤਰ੍ਹਾਂ ਦੇ ਸਵੈਟਰ ਬਣਾਉਣੇ ਆਉਂਦੇ ਹਨ ਮੈਂ ਕੋਟੀ ਸਵੈਟਰ ਟੋਪੀ ਜੁਰਾਬਾਂ ਸਭ ਦਸਤਾਨੇ ਸਭ ਕੁਛ ਬਣਾ ਲੈਂਦੀ ਹਾਂ ਕਈ ਵਾਰੀ ਤਾਂ ਮੈਨੂੰ ਮੈਂ ਯੂਟਿਊਬ 'ਤੇ ਵੀ ਦੇਖ ਲੈਂਦੀ ਹਾਂ ਕਿ ਕਿੱਦਾਂ ਡਿਜ਼ਾਇਨ ਪਾਏ ਜਾਂਦੇ ਹਨ ਮੈਂ ਉਹਨਾਂ ਤੋਂ ਵੀ ਸਿੱ ਕੁ ਕਈ ਵਾਰੀ ਸਿੱ ਸਿੱਖਦੀ ਹਾਂ ਅਤੇ ਕਈ ਵਾਰੀ ਮੈਂ ਪੜੋਸਣ ਦੇ ਘਰ ਵੀ ਜਾਂਦੀ ਹਾਂ ਉਹਦੇ ਕੋਲੋਂ ਵੀ ਚੰਗਾ ਕੋਈ ਸਵੈਟਰ ਲੱਗੇ ਅਤੇ ਮੈਂ ਤਰ੍ਹਾਂ ਤਰ੍ਹਾਂ ਦੇ ਡਿਜਾਇਨ ਬਣਾ ਲੈਂਦੀ ਹਾਂ ਮੈਂ ਕਰੋ ਕਰੋਸ਼ੀਏ ਦੇ ਸਵੈਟਰ ਵੀ ਬਣਾ ਲੈਂਦੀ ਹਾਂ ਅਤੇ ਮੈਨੂੰ ਬੜਾ ਹੀ ਸ਼ੌਂਕ ਹੈ ਕਿ ਮੈਂ ਵੀ ਅੱਜ ਦੇ ਜਮਾਨੇ ਦੇ ਨਾਲ ਚੱਲ ਕੇ ਮੈਂ ਕੁਛ ਕੁ ਕਰ ਸਕਾਂ ਅਤੇ ਉਸ ਕਰਕੇ ਮੈਂ ਸਵੈਟਰ ਬਣਾਉਣੇ ਬਚਪਨ ਤੋਂ ਹੀ ਸਿੱਖੇ ਹਨ ਆਪਣੀ ਦਾਦੀ ਅਤੇ ਮਾਂ ਕੋਲੋਂ ਹੁਣ ਵੀ ਮੈਂ ਆਸ ਪੜੋਸ ਤੋਂ ਜਿੱਥੋਂ ਵੀ ਕੋਈ ਚੰਗਾ ਜਿਹਾ ਲੱਗੇ ਤਾਂ ਮੈਂ ਕਰ ਲੈਂਦੀ ਹਾਂ ਅਤੇ ਮੈਨੂੰ ਸ਼ਿਵਨਾਈ ਦਾ ਬੜਾ ਸ਼ੌਂਕ ਹੈ ਸਵੈਟਰ ਬਣਾਉਣਾ ਮੇਰੀ ਹੋਬੀ ਹੈ ਅਤੇ ਮੈਂ ਉਹਨਾਂ ਨੂੰ ਬੜੇ ਸ਼ੌਂਕ ਨਾਲ ਬਣਾਉਂਦੀ ਹਾਂ ਅਤੇ ਅਤੇ ਉਨ ਅਤੇ ਮੈਨੂੰ ਉਹ ਦਸਤਾਨੇ ਟੋਪੀਆਂ ਜੁਰਾਬਾਂ ਅਤੇ ਜਿਹੜੀਆਂ ਲੱਤਾਂ ਦੇ ਉੱਤੇ ਪਾਈਆਂ ਜਾਂਦੀਆਂ ਹਨ ਜੁਰਾਬਾਂ ਉਹ ਵੀ ਬੁਣ ਲੈਂਦੀ ਹਾਂ ਅਤੇ ਸ਼ੁਕਰ ਹੈ ਸ਼ੁਕ